ਰੂਪਨਗਰ ਵਿੱਚ ਸ਼ਹੀਦਾਂ ਦੀ ਯਾਦ ਵਿੱਚ ਕਈ ਸਾਰੇ ਮੇਲੇ ਰੱਖੇ ਜਾਂਦੇ ਹਨ ਜਿੱਦਾਂ ਕਿ ਭੱਠਾ ਸਾਹਿਬ ਲੱਗਣ ਵਾਲਾ ਸ਼ਹੀਦੀ ਜੋੜ ਮੇਲਾ ਅਤੇ ਰੂਪਨਗਰ ਸ਼ਹੀਦਾਂ ਦੀ ਧਰਤੀ ਹੈ ਅਤੇ ਇੱਥੇ ਹਰ ਦਸਮੀ ਨੂੰ ਸ਼ਹੀਦਾਂ ਦੀ ਯਾਦ ਵਿੱਚ ਕੋਈ ਨਾ ਕੋਈ ਮੇਲਾ ਲੱਗਦਾ ਹੀ ਰਹਿੰਦਾ ਹੈ ਅਤੇ ਇੱਥੇ ਖੇ ਖੇਤਰੀ ਲੈਵਲ ਉੱਤੇ ਬਹੁਤ ਸਾਰੀਆਂ ਖੇਡਾਂ ਖੇਡੀਆਂ ਜਾਂਦੀਆਂ ਹਨ ਸਾਡੇ ਪਿੰਡਾਂ ਵਿੱਚ ਕ ਬਹੁਤ ਸਾਰੇ ਫੁੱਟਬਾਲ ਦੇ ਟੂਰਨਾਮੈਂਟ ਹੁੰਦੇ ਹਨ ਜੋ ਕਿ ਪੂਰੇ ਰੂਪਨਗਰ ਵਿੱਚ ਹੁੰਦੇ ਹਨ ਇੱਥੇ ਨਹਿਰੂ ਸਟੇਡੀਅਮ ਵਿੱਚ ਕਈ ਰਾਸ਼ਟਰੀ ਤਿਉਹਾਰ ਵੀ ਮਨਾਏ ਜਾਂਦੇ ਹਨ